ਬਟ ਉਹਨਾਂ ਸਾਰਿਆਂ ਨੂੰ ਵੀ ਬਹੁਤ ਸੋਹਣੀਆਂ ਲੱਗੀਆਂ ਆ ਇਹਦੀ ਚਾਂਦੀ ਜਿਹੜੀ ਆ ਉਹ ਵੀ ਬਹੁਤ ਸੋਹਣੀ ਸੀਗੀ ਜਿੱਦਾਂ ਇਹਦੇ ਹੁੱਕ ਵਗੈਰਾ ਜਿਹੜੀ ਲੱਗੀ ਹੋਈ ਆ ਉਹ ਵੀ ਬਹੁਤ ਸੋਹਣੀ ਸੀ ਅਤੇ ਇਹਦੇ 'ਚ ਘੁੰਗਰੂ ਵੀ ਬਹੁਤ ਜ਼ਿਆਦਾ ਸੀਗੇ ਜਿਹੜੀਆਂ ਕਿ ਜਦੋਂ ਮੈਂ ਪਾਉਂਦੀ ਸੀ ਬਹੁਤ ਸੋਹਣੇ ਛਣ ਛਣ ਲ ਕਰਦੀਆਂ ਬਹੁਤ ਸੋਹਣੀਆਂ ਲੱਗਦੀਆਂ ਸੀਗੀਆਂ ਅਤੇ ਮਤਲਬ ਜਿਹੜੀ ਇਹਦੀ ਪੈਕੇਜਿੰਗ ਸੀਗੀ ਉਹ ਵੀ ਬਹੁਤ ਵਧੀਆ ਸੀਗੀ ਬਹੁਤ ਸੋਹਣੇ ਤਰੀਕੇ ਨਾਲ ਪੈਕ ਕੀਤੀਆਂ ਹੋਈਆਂ ਸੀਗੀਆਂ ਅਤੇ ਜਿਹੜਾ ਡਿਲੀਵਰੀ ਬੋਏ ਦੇਣ ਆਇਆ ਸੀ ਉਹ ਵੀ ਬਹੁਤ ਵਧੀਆ ਸੀ ਕੀ ਸਾ ਜਿਹੜੀਆਂ ਝਾਂਜਰਾਂ ਮੇਰੇ ਘਰ ਫੜਾ ਕੇ ਗਿਆ ਆ ਮੈਨੂੰ ਮੇਰੇ ਗੇਟ ਦੇ ਅੱਗੇ ਫੜਾ ਕੇ ਗਿਆ ਸੀਗਾ ਅਤੇ ਬਹੁਤ ਵਧੀਆ ਸੀਗਾ ਤੇਅ ਇਹਦਾ ਜਿਹੜਾ ਪ੍ਰਾਈਜ ਸੀਗਾ ਉਹ ਵੀ ਮਾਰਕੀਟ ਦੇ ਨਾਲੋਂ ਬਹੁਤ ਘੱਟ ਸੀਗਾ ਬਹੁਤ ਵਧੀਆ ਲੱਗਿਆ ਸਾਰਿਆਂ ਨੂੰ ਬਹੁਤ ਧੰਨਵਾਦ ਜੀ ਤੁਹਾਡਾ